ਪਹਿਲਾਂ ਤਾਂ ਮਾਹੌਲ ਯਾਦ ਕਰਦੇ ਹਾਂ ਘਰ ਕੱਚੇ ਸੀਗੇ ਔਰ ਗਾਰੇ ਨਾਲ ਲਿੱਪਦੇ ਸੀ ਗੋਹਾ ਵੀ ਫੇਰਦੇ ਸੀਗੇ ਔਰ ਘਰ ਦੇ ਵਿੱਚ ਪਾਰ ਗੇੜੇ ਵਿਹੜੇ ਵਿੱਚ ਰਹਿੰਦੇ ਸੀਗੇ ਅਤੇ ਵਧੀਆ ਸਾਗ ਵਗੈਰਾ ਬਣਾਉਂਦੇ ਸੀਗੇ ਬਹੁਤ ਵਧੀਆ ਮਾਹੌਲ ਸੀਗੇ ਇੱਦਾਂ ਦੇ ਘਰ ਸੀਗੇ ਮਤਲਬ ਜਿਹੜੇ ਮਤਲਬ ਠੰਡੇ ਸੀਗੇ ਬਹੁਤ ਨੀਵੇਂ ਘਰ ਸੀਗੇ ਕੱਚੇ ਘਰ ਸੀ ਛੋਟੇ ਘਰ ਸੀ ਔਰ ਬਹੁਤ ਮਨ ਨੂੰ ਸਕੂਨ ਮਿਲਦਾ ਸੀ ਇਸ ਕਰਕੇ ਜੀ ਪੁਰਾਣੀ ਸਭਿਆਚਾਰ ਉਹ ਅੱਜ ਵੀ ਯਾਦ ਆਉਂਦੀ ਹੈ ਕਿਉਂਕਿ ਇੱਦਾਂ ਦੇ ਲੋਕ ਸੀ ਲੋਕ ਆ ਕੇ ਬਾਅਦ ਆਪਣੇ ਖੁੰਡਾਂ 'ਤੇ ਬੈਠ ਜਾਂਦੇ ਸੀ ਸਾਰੀ ਗੱਲਬਾਤ ਕਰਦੇ ਸੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੀ ਕਰਦੇ ਅੱਜ ਕੱਲ੍ਹ ਦਾ ਮਾਹੌਲ ਮਤਲਬ ਬਹੁਤ ਚੇਂਜ ਹੋ ਗਿਆ ਤੋ ਇੱਦਾਂ ਸੀਗਾ ਵੀ ਮਤਲਬ ਜਿਹੜੇ ਲੋਕ ਸੀਗੇ ਅੱਜ ਕੱਲ੍ਹ ਦਾ ਮਾਹੌਲ ਇੱਦਾਂ ਦਾ ਹੈਗਾ ਲੋਕ ਚੁਗਲੀਆਂ ਅਤੇ ਇੱਕ ਦੂਜੇ ਦੀਆਂ ਬੁਰਿਆਈਆਂ ਕਰਦੇ ਆ ਉਦੋਂ ਲੋਕ ਸੱਚੇ ਸੀਗੇ ਸੱਚੇ ਮਨ ਨਾਲ ਸੱਚੀਆਂ ਗੱਲਾਂ ਉਹ ਤਾਂ ਕਰਨੀਆਂ ਸੱਚੇ ਸੱਚੇ ਖਿਆਲ ਔਰ ਸੱਚੀ ਮਤਲਬ ਹੈਗੀ ਜਿਹੜੀ ਆਪਣੀ ਗੱਲਬਾਤ ਕਰਦੇ ਸੀਗੇ ਕੋਈ ਕਿਸੇ ਨੂੰ ਇੱਦਾਂ ਦਾ ਫਿਕਰ ਨਹੀਂ ਸੀਗਾ ਜੇ ਘਰ ਦੇ ਵਿੱਚ ਕੁੰਡਾ ਵੀ ਨਹੀਂ ਲੱਗਦਾ ਅਤੇ ਕੋਈ ਇੱਦਾਂ ਦਾ ਨਹੀਂ ਕੋਈ ਡਰ ਭੋ ਵਾਲੀ ਨਹੀਂ ਸੀ ਗੱਲ ਅਤੇ ਇਸ ਕਰਕੇ ਮਤਲਬ ਜਿਹੜੀ ਹੈਗੀ ਆ ਬਹੁਤ ਵਧੀਆ ਸੀ ਉਦੋਂ ਕੋਈ ਮਤਲਬ ਕੋਈ ਵੀ ਡਰ ਭੋ ਨਹੀਂ ਸੀ ਅੱਜ ਕੱਲ੍ਹ ਦਾ ਮਾਹੌਲ ਤਾਂ ਬਹੁਤ ਚੇਂਜ ਹੋ ਰਿਹਾ ਇਸ ਕਰਕੇ ਜਿਹੜੀ ਪੁਰਾਣੀ ਸੱਭਿਆਚਾਰ ਹੁਣ ਯਾਦ ਆ ਰਹੀ ਹੈ ਅਤੇ ਬਹੁਤ ਵਧੀਆ ਲੋਕ ਆ ਵਧੀਆ ਸਾਗ ਬਣਾਉਂਦੇ ਸੀ ਮੱਕੀ ਦੀ ਰੋਟੀ ਖਾਂਦੇ ਸੀਗੇ ਵਧੀਆ ਵਧੀਆ ਉਹ ਹਾਰੇ ਦੇ ਵਿੱਚ ਦੁੱਧ ਕਾਢਨੀ ਵਾਲਾ ਪੀਂਦੇ ਸੀਗੇ ਅਤੇ ਦੁੱਧ ਬਹੁਤ ਸੀਗਾ ਵਧੀ ਵਧੀਆ ਲੱਗਦਾ ਸੀ ਉਹ 'ਚ ਮਿੱਠਾ ਪਾਣ ਦੀ ਲੋੜ ਨਹੀਂ ਸੀ ਪੈਂਦੀ ਅਤੇ ਲੋਕ ਅੱਧ ਅੱਧ ਰਿੜਕਿਆ ਸਵੇਰੇ ਪੀਂਦੇ ਸੀ ਜਦੋਂ ਆਉਂਦੇ ਸੀ ਲੱਸੀ ਪੀਂਦੇ ਸੀਗੇ ਮੱਖਣ ਖਾਂਦੇ ਸੀ ਹੁਣ ਅੱਜ ਕੱਲ੍ਹ ਤਾਂ ਲੋਕ ਮੱਖਣ ਲੋਕ ਦੁੱਧ ਭੁੱਲ ਹੀ ਗਏ ਹੁਣ ਤਾਂ ਅੱਜ ਕੱਲ੍ਹ ਦੂਜੇ ਬਰਗਰ ਅਤੇ ਪੀਜ਼ੇ ਖਾਣ ਲੱਗ ਪਏ ਇਸ ਕਰਕੇ ਮਤਲਬ ਹੈਗਾ ਜਿਹੜਾ ਬਹੁਤ ਵਧੀਆ ਮਾਹੌਲ ਸੀਗਾ